ਬਾਈਕਿੰਗ ਕਮਿਊਨਿਟੀ ਅੱਜ ਕੱਲ੍ਹ ਜੀਵਨ ਦਾ ਅਨਿਖੜਵਾਂ ਅੰਗ ਬਣਦੀ ਜਾ ਰਹੀ ਹੈ ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਬਾਈਕਿੰਗ ਵੱਲ ਬਹੁਤ ਹੀ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਤਾਂ ਇਸ ਕਰਕੇ ਹਰੇਕ ਸ਼ਹਿਰ ਜ਼ਿਲ੍ਹੇ ਸਿਟੀ ਵਿੱਚ ਅਲੱਗ ਅਲੱਗ ਬਾਈਕਿੰਗ ਕਮਿਊਨਿਟੀਆਂ ਹੁੰਦੀਆਂ ਹਨ ਜਿਹਨਾਂ ਵਿੱਚ ਬਹੁਤ ਸਾਰੇ ਰਾਈਡਰ ਰਜਿਸਟਰ ਹੁੰਦੇ ਹਨ ਇਹ ਹਰ ਮਹੀਨੇ ਕਿਸੇ ਇੱਕ ਦਿਨ ਜਾਂ ਐਤਵਾਰ ਵਾਲੇ ਦਿਨ ਬਾਈਕਿੰਗ ਕਰਨ ਲਈ ਰੋਡਾਂ ਉੱਤੇ ਜਾਂਦੇ ਹਨ ਜਿਹਨਾਂ ਵਿੱਚ ਇਹ ਅਲੱਗ ਅਲੱਗ ਤਰ੍ਹਾਂ ਦੇ ਸਟੰਟਸ ਵਗੈਰਾ ਕਰਦੇ ਹਨ ਜੋ ਕਿ ਬਹੁਤ ਹੀ ਆਕਰਸ਼ਿਕ ਹੁੰਦੇ ਹਨ ਬਾਈਕਿੰਗ ਕਮਿਊਨਿਟੀ ਵਿੱਚ ਜੁਆਇਨ ਕਰਨ ਲਈ ਅਲੱਗ ਵੱਖ ਵੱਖ ਤਰੀਕੇ ਹੁੰਦੇ ਹਨ ਜਿਵੇਂ ਕਿ ਟਕਨੋਲਜੀ ਕਰਕੇ ਅੱਜ ਕੱਲ੍ਹ ਲੋਕ ਵੈਬਸਾਈਟਾਂ ਬਣਾਈਆਂ ਗਈਆਂ ਹਨ ਜਿਹਨਾਂ ਵਿੱਚੋਂ ਵੱਖ ਵੱਖ ਵੱਖ ਰਾਈਡਰ ਰਜਿਸਟਰ ਕਰਦੇ ਹਨ ਤਾਂ ਕਿ ਉਹ ਉਸ ਗਰੁੱਪ ਨੂੰ ਜੁਆਇਨ ਕਰ ਸਕਣ ਪਰ ਜਿਸ ਤਰ੍ਹਾਂ ਕਿ ਆਪਾਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਕਮਿਊਨਿਟੀ ਨੂੰ ਜੁਆਇੰਨ ਕਰਨ ਲਈ ਕੁਝ ਫੀਸ ਹੁੰਦੀ ਹੈ ਤਾਂ ਇਸ ਕਰਕੇ ਹਰੇਕ ਬਾਈਕਿੰਗ ਕਮਿਊਨਟੀ ਨੇ ਆਪਣੀ ਇੱਕ ਜਾਇਜ਼ ਫੀਸ ਰੱਖੀ ਹੁੰਦੀ ਹੈ ਜਿਹਨਾਂ ਵਿੱਚ ਅਦਾ ਜਿਹੜੀ ਫੀਸ ਅਦਾ ਕਰਕੇ ਆਪਾਂ ਉਸੇ ਬਾਈਕਿੰਗ ਕਮਿਊਨਿਟੀ ਵਿੱਚ ਜੁਆਇਨ ਕਰ ਸਕਦੇ ਹਾਂ ਉਸ ਤੋਂ ਬਾਅਦ ਉਹ ਬਾਈਕਿੰਗ ਕਮਿਊਨਿਟੀ ਤੁਹਾਨੂੰ ਮੈਸੇਜ ਜਾਂ ਕਾਲ ਰਾਹੀਂ ਸੁਚੇਤ ਕਰਦੀ ਹੈ ਕਿ ਇਸ ਦਿਨ ਇਸ ਟਾਈਮ 'ਤੇ ਬਾਈਕਿੰਗ ਕਮਿਊਨਿਟੀ ਦੀ ਰਾਈਡ ਹੈ ਸੋ ਆਪਣੇ ਮੋਟਰ ਬਾਈਕ ਮੋਟਰਸਾਈਕਲ ਲੈ ਕੇ ਉਸ ਕਮਿਊਨਿਟੀ ਦੀ ਰਾਈਡ ਵਿੱਚ ਸ਼ਾਮਿਲ ਹੋਵੋ ਜੋ ਕਿ ਬਹੁਤ ਹੀ ਮਨ ਪਰਚਾਵਕ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਹਰੇਕ ਆਪਣੇ ਤਰ੍ਹਾਂ ਦੀ ਰੁਚੀ ਵਾਲੇ ਲੋਕਾਂ ਨੂੰ ਮਿਲਦੇ ਹਾਂ ਤਾਂ ਆਪਣਾ ਸੈਂਸ ਆਫ ਹਿਊਮਰ ਐਂਡ ਨੇਚਰ ਬਹੁਤ ਹੀ ਵਧੀਆ ਹੁੰਦਾ ਹੈ ਕਿਉਂਕਿ ਆਪਾਂ ਨੂੰ ਹਰੇਕ ਤਰ੍ਹਾਂ ਦਾ ਬੰਦਾ ਉਸ ਕਮਿਊਨਿਟੀ ਵਿੱਚ ਮਿਲਦਾ ਹੈ ਜੋ ਕਿ ਹਰ ਤਰ੍ਹਾਂ ਦੀਆਂ ਵੱਖੋ ਵੱਖਰੀਆਂ ਬਾਈਕਾਂ ਨੂੰ ਜਾਣਦਾ ਪਹਿਚਾਣਦਾ ਹੋਵੇ ਉਹਨਾਂ ਦੀਆਂ ਐਡਵਾਂਟੇਜਸ ਐਂਡ ਡਿਸਅਡਵਾਂਟੇਜ ਜਾਣਦਾ ਹੋਵੇ ਜੋ ਕਿ ਸਾਨੂੰ ਨਵੀਂ ਬਾਈਕ ਲੈਣ ਲਈ ਬਹੁਤ ਹੀ ਵਧੀਆ ਸਲਾਹ ਦੇ ਸਕਦਾ ਹੈ ਤਾਂ ਮੈਂ ਤਾਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਬਾਈਕਿੰਗ ਕਮਿਊਨਿਟੀ ਵਿੱਚ ਸ਼ਾਮਿਲ ਜ਼ਰੂਰ ਹੋਣਾ ਚਾਹੀਦਾ ਹੈ ਜੇਕਰ ਤੁਹਾਡਾ ਬਾਈਕਿੰਗ ਵਿੱਚ ਬਹੁਤ ਹੀ ਵਧੀਆ ਇੰਟਰਸਟ ਹੈ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜੀਅ ਸਕੋ